ਮੈਂ ਆਨਲਾਈਨ ਆਰਡਰ ਤੇ ਹੈਡਫੋਨਸ ਮੰਗਾਏ ਸੀ ਇਹਨਾਂ ਦੀ ਕੁਆਲਿਟੀ ਬਹੁਤ ਹੀ ਸ਼ਾਨਦਾਰ ਸੀ ਇਹ ਹੈਡਫੋਨਸ ਨੋਇਸ ਕੰਪਨੀ ਦੇ ਸਨ ਇਹ ਹੈਡਫੋਨਸ ਵਾਇਰਲੈਸ ਤੇ ਵਾਇਰਿੰਗ ਦੋਨਾਂ ਨਾਲ ਹੀ ਆਪਾਂ ਅਟੈਚ ਕਰਕੇ ਕੁਝ ਵੀ ਸੁਣ ਸਕਦੇ ਹਾਂ ਇਹ ਹੈਡਫੋਨ ਦੀ ਆਵਾਜ਼ ਬਿਲਕੁਲ ਸਾਫ ਤੇ ਬਹੁਤ ਵਧੀਆ ਸੀ ਇਹਨਾ ਹੈਡਫੋਨਸ ਦੀ ਛੇ ਮਹੀਨੇ ਦੀ ਗਰੰਟੀ ਵੀ ਸੀ ਇਨਾ ਹੈਡਫੋਨਸ ਦੀ ਚਾਰਜਿੰਗ ਕੁਆਲਿਟੀ ਵੀ ਕਾਫੀ ਛੇਤੀ ਚਾਰਜ ਹੋ ਜਾਂਦੇ ਹਨ ਇਹ ਹੈਡਫੋਨਸ ਦੀ ਦੀ ਬੈਟਰੀ ਵੀ ਕਾਫੀ ਲੰਬੇ ਸਮੇਂ ਤੱਕ ਚੱਲਦੀ ਹੈ ਇਹ ਹੈਡਫੋਨਸ ਨੂੰ ਚਾਰਜ ਕਰਦੇ ਕਰਨ ਵਿੱਚ ਜਿਆਦਾ ਲੰਬਾ ਸਮਾਂ ਨਹੀਂ ਲੱਗਦਾ ਇਹ ਬਹੁਤ ਛੇਤੀ ਚਾਰਜ ਹੋ ਜਾਂਦੇ ਸਨ ਇਹਨਾਂ ਦੇ ਵਿੱਚ ਸਾਰੀ ਕੁਆਲਿਟੀ ਵਧੀਆ ਸੀ